ਪੁਰਾਤਨ ਸਮਿਆਂ ਵਿੱਚ ਖਾਣਾ ਪਕਾਉਣ ਲਈ ਲੋਕ ਜ਼ਿਆਦਾਤਰ ਘਰ ਦੇ ਜੜੀ ਬੂਟੀਆਂ ਤੋਂ ਬਣੇ ਮਸਾਲਿਆਂ ਦੇ ਪਕਵਾਨ ਬਣਾਉਂਦੇ ਜੋ ਬਹੁਤ ਸਵਾਦੀ ਭੋਜਨ ਬਣਾਉਣ ਵਿੱਚ ਸਹਾਈ ਹੁੰਦੇ ਅਸੀਂ ਵੀ ਆਪਣੇ ਘਰ ਵਿੱਚ ਖਾਣਾ ਪਕਾਉਣ ਲਈ ਜੜੀ ਬੂਟੀਆਂ ਦੀ ਵਰਤੋਂ ਕਰਦੇ ਹਾਂ ਜਿਵੇਂ ਹਿੰਗ ਹੋ ਗਈ ਮੇਥੀ ਪਾਲਕ ਧਨੀਆ ਹਾਲੋ ਦੀ ਭੁਰਜੀ ਆਦਿ ਹੋਰ ਵੀ ਕਈ ਜੜੀ ਬੂਟੀਆਂ ਹਨ ਜਿਹਨਾਂ ਦੀ ਵਰਤੋਂ ਅਸੀਂ ਆਪਣੇ ਖਾਣੇ ਨੂੰ ਬਣਾਉਣ ਵਿੱਚ ਕਰਦੇ ਹਾਂ ਜਿਵੇਂ ਮੇਥੀ ਨੂੰ ਅਸੀਂ ਸੁਕਾ ਕੇ ਰੱਖ ਲੈਂਦੇ ਹਾਂ ਅਤੇ ਇਸ ਦੀ ਵਰਤੋਂ ਪਕੌੜੇ ਬਣਾਉਣ ਸੁੱਕੀ ਸਬਜ਼ੀ ਬਣਾਉਣ ਜਾਂ ਕਿਤੇ ਹੋਰ ਵੀ ਵਰਤੋਂ ਕੀਤੀ ਜਾਂਦੀ ਹੈ ਇਹ ਸਾਨੂੰ ਸਵਾਦ ਦੇਣ ਦੇ ਨਾਲ ਨਾਲ ਸਿਹਤ ਨੂੰ ਵੀ ਸਹੀ ਰੱਖਣ ਵਿੱਚ ਮਦਦ ਕਰਦੀ ਹੈ ਇਸ ਤੋਂ ਇਲਾਵਾ ਧਨੀਆ ਜਿਸ ਦੀ ਤਸੀਰ ਠੰਡੀ ਹੈ ਇਸ ਦੀ ਵਰਤੋਂ ਸਬਜ਼ੀ ਜਦੋਂ ਬਣ ਜਾਂਦੀ ਹੈ ਉਸ ਉੱਪਰ ਉਹ ਧੂੜ ਦਿੱਤਾ ਜਾਂਦਾ ਸਬਜ਼ੀ ਦੀ ਦਿਖ ਸੋਹਣੀ ਲੱਗਣ ਲੱਗ ਜਾਂਦੀ ਹੈ ਹੋਰ ਪੁਦੀਨੇ ਦੀ ਚਟਨੀ ਤੋਂ ਪਾਚਨ ਸ਼ਕਤੀ ਵਧਾਈ ਜਾਂਦੀ ਹੈ